ਹਾਂਜੀ ਹਾਂਜੀ ਭਾਅ ਜੀ ਸੋਨੀ ਹੈਲਥ ਕਲੱਬ ਤੋਂ ਬੋਲ ਰਿਹਾ ਭਾਅ ਜੀ ਓਕੇ ਟਾਈਮਿੰਗ ਸਰ ਇੱਕ ਮੋਰਨਿੰਗ ਦੀ ਹੈ ਇੱਕ ਇਵਨਿੰਗ ਦੀ ਹੈ ਤੁਹਾਡੀ ਏਜ ਕਿੰਨੀ ਹੈ ਸਰ ਚਲੋ ਠੀਕ ਹੈ ਐਂਡ ਤੁਹਾਡਾ ਵੇਟ ਠੀਕ ਹੈ ਅਤੇ ਤੁਸੀਂ ਕਾਰਡੀਓ ਕਰਨਾ ਚਾਹੁੰਦੇ ਹੋ ਰਨਿੰਗ ਕਰਨਾ ਚਾਹੁੰਦੇ ਹੋ ਕਿ ਪ੍ਰੋਪਰ ਐਕਸਰਸਾਈਜ ਹਾਲੇ ਤਾਂ ਤੁਹਾਡੇ ਹੋਣੀ ਨਹੀਂ ਪਹਿਲੇ ਅਸੀਂ ਥੋੜ੍ਹਾ ਵੇਟ ਲੂਜ਼ ਕਰਾਂਗੇ ਉਸ ਤੋਂ ਬਾਅਦ 'ਚੋਂ ਅਸੀਂ ਐਕਸਰਸਾਈਜ ਵਾਲੀ ਸਾਈਡ ਆਵਾਂਗੇ ਇਹਨੂੰ ਅਸੀਂ ਕਹਿ ਸਕਦੇ ਹਾਂ ਮਸ਼ੀਨਾਂ ਸਰ ਪ੍ਰੋਪਰ ਹੈਗੀਆਂ ਨੇ ਅਸੀਂ ਪਹਿਲਾਂ ਤੁਹਾਨੂੰ ਪਹਿਲਾਂ ਰਨਿੰਗ ਕਰਵਾਵਾਂਗੇ ਉਸ ਤੋਂ ਬਾਅਦ 'ਚ ਜੰਪਿੰਗ ਵਗੈਰਾ ਕਰਵਾ ਕੇ ਕਾਰਡੀਓਜ਼ ਵਗੈਰਾ ਕਰਵਾ ਕੇ ਉਸ ਤੋਂ ਬਾਅਦ 'ਚੋਂ ਫਿਰ ਤੁਹਾਨੂੰ ਜਿਹੜਾ ਜਿਹੜਾ ਜਿਹੜਾ ਚੱਲੇਗਾ ਉਹ ਫਿਰ ਤੁਹਾਡਾ ਵੇਟ ਲਿਫਟਿੰਗ ਚੱਲੇਗਾ ਠੀਕ ਹੈ ਜੀ ਉਹ ਤੁਹਾਡੇ ਉੱਪਰ ਉਹ ਤੁਹਾਡੇ ਉੱਪਰ ਡਿਪੈਂਡ ਹੈਗਾ ਕਿ ਤੁਸੀਂ ਕਿੰਨਾ ਵੇਟ ਗ ਗੇਨ ਕਰਨਾ ਚਾਹੁੰਦੇ ਹੋ ਜਾਂ ਲੂਜ ਕਰਨਾ ਚਾਹੁੰਦੇ ਹੋ ਉਹ ਤੁਸੀਂ ਆਓਗੇ ਮਿਲੋਗੇ ਅਤੇ ਫਿਰ ਤੁਹਾਡੇ ਕੋਲੋਂ ਪ੍ਰੋਪਰ ਇੱਕ ਤੁਹਾਡੀ ਨੀਡ ਕੀ ਹੈ ਤੁਸੀਂ ਕਿਸ ਤਰ੍ਹਾਂ ਦੀ ਬੋਡੀ ਚਾਹੁੰਦੇ ਹੋ ਕਈ ਬਲਕੀ ਚਾਹੁੰਦੇ ਨੇ ਕਈ ਸਲਿਮ ਚਾਹੁੰਦੇ ਨੇ ਮਸਕੂਲਰ ਚਾਹੁੰਦੇ ਨੇ ਫਿਰ ਉਸ ਹਿਸਾਬ ਨਾਲ ਹਾਂਜੀ ਡੈਮੋ ਕਲਾਸਿਜ਼ ਸਰ ਤੁਹਾਨੂੰ ਟੂ ਡੇਜ ਲਈ ਮਿਲ ਸਕਦੀਆਂ ਉਸ ਤੋਂ ਬਾਅਦ 'ਚ ਫਿਰ ਤੁਹਾਨੂੰ ਟੂ ਡੇਜ ਲਈ ਤੁਹਾਨੂੰ ਐਟਮੋਸਫੇਅਰ ਦਾ ਪਤਾ ਲੱਗ ਜਾਏਗਾ ਵੀ ਕਿੱਦਾਂ ਦਾ ਹੈਗਾ ਅਤੇ ਤੁਸੀਂ ਕਿੱਦਾਂ ਅੱਗੇ ਚੱਲ ਸਕਦੇ ਹੋ ਕਿ ਨਹੀਂ ਚੱਲ ਸਕਦੇ ਅਗਰ ਤੁਹਾਨੂੰ ਠੀਕ ਲੱਗੇਗਾ ਮੋਸਟ ਵੈਲਕਮ ਹੈ ਜੀ ਠੀਕ ਹੈ ਭਾਅ ਜੀ ਠੀਕ ਹੈ ਸਰ ਠੀਕ ਹੈ ਓਕੇ ਜੀ ਓਕੇ ਜੀ